ਆਮ ਤੌਰ 'ਤੇ ਤਾਂ ਮੈਨੂੰ ਸਾਡੇ ਪਰਿਵਾਰ ਦਾ ਹੀ ਖਾਣਾ ਬਣਾਉਣਾ ਪੈਂਦਾ ਪਰ ਇੱਕ ਮੌਕਾ ਸੀ ਜਦੋਂ ਸਾਡੇ ਘਰ ਬੜੇ ਸਾਰੇ ਮਹਿਮਾਨ ਆ ਗਏ ਅਤੇ ਅਸੀਂ ਦਾਵਤ 'ਤੇ ਖਾਣਾ ਬਣਾਇਆ ਅਤੇ ਉਸ ਟਾਈਮ 'ਤੇ ਮੈਨੂੰ ਪੱਚੀ ਲੋਕਾਂ ਦਾ ਖਾਣਾ ਇਕੱਠਾ ਬਣਾਉਣ ਦਾ ਮੌਕਾ ਮਿਲਿਆ ਅਤੇ ਐਨੇ ਲਈ ਤੁਹਾਨੂੰ ਤਜ਼ਰਬਾ ਵੀ ਚਾਹੀਦਾ ਅਤੇ ਮੈਂ ਪਹਿਲੀ ਵਾਰੀ ਬਣਾ ਰਹੀ ਸੀ ਪਰ ਮੈਂ ਡਰ ਵੀ ਰਹੀ ਸੀ ਅੰਦਰੋਂ ਅਤੇ ਪਰ ਚੀਜ਼ਾਂ ਮੈਂ ਅੰਦਾਜ਼ੇ ਦੇ ਨਾਲ ਵਰਤੀਆਂ ਅਤੇ ਮੈਨੂੰ ਮੈਂ ਉਸ ਹਿਸਾਬ ਨਾਲ ਜਿੰਨਾ ਚਾਰ ਲਈ ਹੁੰਦਾ ਓਨਾ ਮੈਂ ਉਹਨੂੰ ਉਸ ਹਿਸਾਬ ਨਾਲ ਤਰੀਕੇ ਨਾਲ ਮੁਲਟੀਪਲਾਈ ਕਰ ਲਿਆ ਗੁਣਾ ਕਰਕੇ ਮੈਂ ਪੱਚੀ ਬੰਦਿਆਂ ਦਾ ਬਣਾ ਲਿਆ ਅਤੇ ਬੜੇ ਸਾਰੇ ਮੈਂ ਪਹਿਲਾਂ ਆਪਣਾ ਮੀਨੂ ਬਣਾਇਆ ਵੀ ਮੈਂ ਕੀ ਕੀ ਬਣਾਉਣਾ ਫੇਰ ਉਸ ਹਿਸਾਬ ਨਾਲ ਮੈਂ ਚੀਜ਼ਾਂ ਖਰੀਦੀਆਂ ਅਤੇ ਫਿਰ ਮੈਂ ਉਹਨੂੰ ਬੜੇ ਤਰੀਕੇ ਵਾਰ ਤਰੀਕੇ ਨਾਲ ਕੰਮ ਕੀਤਾ ਪਰ ਵਧੀਆ ਗੱਲ ਇਹ ਸੀ ਵੀ ਬਹੁਤ ਵਧੀਆ ਜਿਹੜਾ ਖਾਣਾ ਬਣਿਆ ਅਤੇ ਸਾਰੇ ਮਹਿਮਾਨਾਂ ਨੇ ਬੜਾ ਮੇ ਮੇਰੀ ਪ੍ਰਸ਼ੰਸਾ ਕੀਤੀ ਉਹਦੇ ਲਈ ਮੈਨੂੰ ਕੰਮ ਥੋੜ੍ਹਾ ਜਿਹਾ ਤਰੀਕੇ ਨਾਲ ਕਰਨਾ ਪਿਆ ਕਿਉਂਕਿ ਐਂ ਸੀ ਵੀ ਐਨੇ ਬੰਦਿਆਂ ਦੇ ਖਾਣੇ ਲਈ ਇਕ ਦਮ ਜ਼ਿਆਦਾ ਜਿਹੜਾ ਹੈਗਾ ਆਪਾਂ ਥੋੜ੍ਹਾ ਬਣਾਉਣਾ ਬਹੁਤ ਸੌਖਾ ਜ਼ਿਆਦਾ ਲਈ ਆਪਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਅਤੇ ਮੈਂ ਉਹਦੇ ਲਈ ਪਹਿਲਾਂ ਤਾਂ ਸਾਰਾ ਸਮਾਨ ਇਕੱਠਾ ਕਰਕੇ ਰੱਖਿਆ ਤਾਂ ਜੋ ਮੈਨੂੰ ਭੱਜ ਦੌੜ ਨਾ ਕਰਨੀ ਪਵੇ ਅਤੇ ਇਹਦੇ ਦੂਸਰਾ ਮੈਨੂੰ ਸਾਰੀਆਂ ਚੀਜ਼ਾਂ ਇਕੱਠੀਆਂ ਰੱਖੀਆਂ ਹੋਈਆਂ ਵੀ ਇੱਕ ਇੱਕ ਚੀਜ਼ ਲਈ ਮੈਨੂੰ ਕੀ ਕੀ ਚਾਹੀਦਾ ਸਾਰੇ ਮਸਾਲੇ ਦਾਲਾਂ ਸਭ ਕੁਛ ਮੈਂ ਉਸ ਤਰੀਕੇ ਨਾਲ ਇੱਕ ਤਰੀਕੇ ਨਾਲ ਬਣਾ ਕੇ ਰੱਖ ਲਿਆ ਤਾਂ ਜੋ ਮੈਨੂੰ ਕੋਈ ਔਖਾ ਨਾ ਹੋਵੇ ਅਤੇ ਇੱਕ ਮੌਕੇ ਸਿਰ ਭੱਜ ਦੌੜ ਨਾ ਕਰਨੀ ਪਵੇ ਦੂਜਾ ਮੈਂ ਆਪਦੇ ਸਾਰੇ ਬਰਤਨ ਜਿਹੜੇ ਸੀਗੇ ਉਹ ਜਿਹੜੇ ਚਾਹੀਦੇ ਸੀ ਉਹ ਇੱਕ ਦਿਨ ਪਹਿਲਾਂ ਤਿਆਰ ਕਰਕੇ ਰੱਖ ਲਏ ਵੀ ਮੈਨੂੰ ਕੀ ਕੀ ਸਮਾਨ ਚਾਹੀਦਾ ਅਤੇ ਕਿਹੜੇ ਕਿਹੜੇ ਭਾਂਡਿਆਂ ਦੀ ਲੋੜ ਪਊਗੀ ਅਤੇ ਉਸ ਤੋਂ ਬਾਅਦ ਮੈਂ ਹਰੇਕ ਦਾ ਸਮਾਂ ਦੇਖ ਲਿਆ ਵੀ ਹਾਂ ਕਿੰਨਾ ਸਮਾਂ ਇੱਕ ਚੀਜ਼ ਨੂੰ ਬਣਾਉਣ ਨੂੰ ਲੱਗਦਾ ਅਤੇ ਉਹਦੇ ਮੁਤਾਬਕ ਜਿਹੜਾ ਮੈਂ ਕੰਮ ਕੀਤਾ ਇਹ ਰਣਨੀਤੀ ਨੇ ਮੈਨੂੰ ਬੜਾ ਸੌਖਾ ਜਿਹੜਾ ਕੀਤਾ ਅਤੇ ਮੈਨੂੰ ਕੰਮ ਵੀ ਪੂਰੇ ਟਾਈਮ 'ਤੇ ਹੋ ਗਿਆ ਅਤੇ ਬੜੇ ਵਧੀਆ ਤਰੀਕੇ ਨਾਲ ਹੋ ਗਿਆ ਇਸ ਕਰਕੇ ਜਿਹੜਾ ਮੈਨੂੰ ਔਖਾ ਨਹੀਂ ਹੋਣਾ ਪਿਆ